ਭਾਰਤ ਵਿੱਚ ਆਵਾਜਾਈ ਬਹੁਤ ਜ਼ਿਆਦਾ ਹੋਈ ਪਈ ਹੈ ਅਤੇ ਲੋਕਾਂ ਕੋਲ ਟੂ ਵੀਲਰ ਫੋਰ ਵੀਲਰ ਟਰੱਕ ਟਰਾਲੀਆਂ ਗੱਡੀਆਂ ਬਹੁਤ ਜ਼ਿਆਦਾ ਹਨ ਅਤੇ ਜਿਸ ਨਾਲ ਲੋਕਾਂ ਦੇ ਐਕਸੀਡੈਂਟ ਜ਼ਿਆਦਾ ਹੁੰਦੇ ਆਂ ਅਤੇ ਜਦੋਂ ਮੈਂ ਰੋਪੜ ਜਾਂਦੀ ਹਾਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਅਤੇ ਸਰਕਾਰ ਨੂੰ ਵੱਧ ਤੋਂ ਵੱਧ ਬੱਸਾਂ ਚਲਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਨਾਲ ਐਕਸੀਡੈਂਟ ਹੋਣ ਦਾ ਖਤਰਾ ਟਲਿਆ ਰਹਿੰਦਾ ਅਤੇ ਬਾਕੀ ਸਰਕਾਰ ਨੂੰ ਪੁਲ ਬਾਈਪਾਸ ਫੋਰ ਲੇਅ 'ਤੇ ਬਣਾਉਣੇ ਚਾਹੀਦੇ ਹਨ